ਛੱਬੀ ਫੈਬਰੇਰੀ ਉੱਨੀ ਸੌ ਅਠਾਨਵੇਂ ਸਤਾਰਾਂ ਫੈਬਰੇਰੀ ਉੱਨੀ ਸੌ ਸੱਤਰ ਛੱਬੀ ਜਨਵਰੀ ਉੱਨੀ ਸੌ ਸੰਤਾਲੀ ਤੇਈ ਜਨਵਰੀ ਦੋ ਹਜ਼ਾਰ ਪੰਜ ਬਾਈ ਮਾਰਚ ਦੋ ਹਜ਼ਾਰ ਨੌ